ਟੈਕਨੋਲਜੀ ਨੇ ਬਹੁਤ ਹੀ ਜ਼ਿਆਦਾ ਮਦਦ ਕੀਤੀ ਹੈ ਜਿੱਦਾਂ ਕਿ ਆਪਾਂ ਕਿਤੇ ਗਰਮੀਆਂ ਦੀ ਜਾਂ ਸਰਦੀਆਂ ਦੀ ਛੁੱਟੀਆਂ ਵਿੱਚ ਘੁੰਮਣ ਜਾਣਾ ਹੋਵੇ ਤਾਂ ਅਸੀਂ ਫੋਨ ਵਿੱਚ ਹੀ ਕਿਸੇ ਵੀ ਹੋਟਲ ਵਿੱਚ ਆਪਣੇ ਕਮਰੇ ਦੀ ਬੁਕਿੰਗ ਕਰਵਾ ਸਕਦੇ ਹਾਂ ਅਤੇ ਜਦ ਅਸੀਂ ਉੱਥੇ ਪਹੁੰਚਦੇ ਹਾਂ ਤਾਂ ਸਾਨੂੰ ਉੱਥੇ ਬਹੁਤ ਹੀ ਵਧੀਆ ਤਰੀਕੇ ਨਾਲ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਅਤੇ ਹੋਟਲ ਵਿੱਚ ਅਸੀਂ ਆਪਣੇ ਕਮਰੇ ਵਿੱਚ ਬੈਠ ਕੇ ਹੀ ਟੈਕਨੋਲੋਜੀ ਦੀ ਸਹਾਇਤਾ ਨਾਲ ਉੱਥੋਂ ਆਪਣੇ ਖਾਣ ਲਈ ਭੋਜਨ ਸਮਾਨ ਆਦਿ ਸਭ ਕੁਝ ਆਪਣੇ ਕਮਰੇ ਵਿੱਚ ਹੀ ਮੰਗਾ ਮਨ ਮੰਗਵਾ ਸਕਦੇ ਹਾਂ ਇਸ ਤਰ੍ਹਾਂ ਟੈਕਨੋਲਜੀ ਨੇ ਸਾਨੂੰ ਬਹੁਤ ਹੀ ਜ਼ਿਆਦਾ ਮਦਦ ਕੀਤੀ ਹੈ ਟੈਕਨੋਲਜੀ ਅੱਜ ਤੋਂ ਬਹੁਤ ਹੀ ਜ਼ਿਆਦਾ ਅੱਗੇ ਪਹੁੰਚ ਗਈ ਹੈ ਟੈਕਨੋਲਜੀ ਇੰਨੀ ਕੁ ਜ਼ਿਆਦਾ ਅੱਗੇ ਪਹੁੰਚ ਗਈ ਕਿ ਬੰਦਾ ਆਪਣੇ ਘਰ ਬੈਠ ਕੇ ਹੀ ਬਹੁਤ ਹੀ ਜ਼ਿਆਦਾ ਚੀਜ਼ਾਂ ਮੰਗਵਾ ਸਕਦਾ ਹੋਟਲ ਵਿੱਚ ਆਪਣਾ ਕਮਰੇ ਵਿੱਚ ਬੈਠ ਕੇ ਹੀ ਅਸੀਂ ਆਪਣੇ ਲਾਗੇ ਸਾਗੇ ਦੀ ਚੀਜ਼ਾਂ ਵੇਖਣ ਵਾਲਿਆਂ ਨੂੰ ਟੈਕਨੋਲਜੀ ਦੀ ਸਹਾਇਤਾ ਨਾਲ ਦੇਖ ਸਕਦੇ ਹਾਂ ਕਿ ਇਹ ਜਗ੍ਹਾ ਜਾਣ ਲਈ ਬਹੁਤ ਵਧੀਆ ਹੈ ਅਤੇ ਘੁੰਮਣ ਲਈ ਬਹੁਤ ਜ਼ਿਆਦਾ ਵਧੀਆ ਚੀਜ਼ਾਂ ਹਨ ਇਸ ਕਰਕੇ ਟੈਕਨੋਲਜੀ ਨੇ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਹੈ